ਫੋਟੋਗ੍ਰਾਫੀ ਦੇ ਲਈ ਵਿਸ਼ੇਸ਼ ਤੌਰ 'ਤੇ ਯਾ ਯਾਤਰਾ ਅਸੀਂ ਬਹੁਤ ਵਾਰ ਕੀਤੀ ਹੈ ਅਸੀਂ ਆਪਣੇ ਆਮ ਲਾਈਫ ਦੇ ਵਿੱਚ ਤਾਂ ਫੋਟੋਗ੍ਰਾਫੀ ਬੜੇ ਓਕੇਜਨਾਂ 'ਤੇ ਬੜੇ ਜਗ੍ਹਾ 'ਤੇ ਕੀਤੀ ਹੈ ਕੋਈ ਵੀ ਫੰਕਸ਼ਨ ਤਿਉਹਾਰ ਹੁੰਦਾ ਹੈ ਤਾਂ ਅਸੀਂ ਫੋਟੋਗ੍ਰਾਫੀ ਕਰਦੇ ਹਾਂ ਬਟ ਵਿਸ਼ੇਸ਼ ਤੌਰ 'ਤੇ ਸਿਰਫ਼ ਫੋਟੋਗ੍ਰਾਫੀ ਲਈ ਅਸੀਂ ਇੱਕ ਵਾਰ ਬਾਹਰ ਗਏ ਸੀ ਜਿਹਦੇ ਵਿੱਚ ਅਸੀਂ ਨੇਚਰ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਸਾਡਾ ਅਨੁਭਵ ਬਹੁਤ ਵਧੀਆ ਰਿਹਾ ਜਿਹਦੇ ਵਿੱਚ ਅਸੀਂ ਪਕਸ਼ੀਆਂ ਦੀ ਪੇੜਾਂ ਦੀ ਪਹਾੜਾਂ ਦੀ ਔਰ ਉੱਥੋਂ ਦੇ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਪਹਾੜਾਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਫੋਟੋਜ਼ ਕਲਿੱਕ ਕੀਤੀਆਂ ਜਿਹੜਾ ਕਿ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਉਹਦੇ ਵਿੱਚ ਸਾਨੂੰ ਉਹਨਾਂ ਦੇ ਬਾਰੇ ਜਾਣਣ ਦਾ ਵੀ ਮੌਕਾ ਮਿਲਿਆ ਅਤੇ ਨਵੀਆਂ ਨਵੀਆਂ ਚੀਜ਼ਾਂ ਵੀ ਐਕਸਪਲੋਰ ਕੀਤੀਆਂ ਅਸੀਂ ਧੰਨਵਾਦ